ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜਿਵੇਂ ਗੌਲਡਨ ਟੈਂਪਲ ਅਤੇ ਹੋਰ ਸਾਰੀਆਂ ਕਈ ਥਾਵਾਂ ਹਨ ਹਾਂਜੀ ਥਾਵਾਂ ਹਨ ਅਤੇ ਜਿਵੇਂ ਅਸੀਂ ਹੋਰ ਥਾਵਾਂ 'ਤੇ ਜਾਂਦੇ ਹਾਂ ਹਿਮਾਚਲ ਪ੍ਰਦੇਸ਼ ਵਿੱਚ ਜਾਂਦੇ ਹਾਂ ਅਸੀਂ ਹਿਮਾਚਲ ਵਿ ਪ੍ਰਦੇਸ਼ ਵਿੱਚ ਪਹਾੜੀਆਂ ਕਾਰਨ ਘੁੰਮਣ ਜਾਂਦੇ ਹਾਂ ਅਤੇ ਜਿਵੇਂ ਸ਼ਿਮਲਾ ਗੋਆ ਰਾਜਸਥਾਨ ਚੰਡੀਗੜ੍ਹ ਚੰਡੀਗੜ੍ਹ ਚਿੜੀਆ ਘਰ ਜਾਂਦੇ ਹਾਂ ਅਸੀਂ ਦੇਖਣ ਅਸੀਂ ਬਹੁਤ ਸ ਖੂਬਸੂਰਤ ਥਾਵਾਂ ਹੈ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਬਹੁਤ ਸਾਰੀਆਂ ਵਧੀਆ ਜਿਵੇਂ ਕਿ ਜੰਮੂ ਕਸ਼ਮੀਰ ਵੱਲ ਵੀ ਅਸੀਂ ਜਾਂਦੇ ਹਾਂ ਜਿਵੇਂ ਗੜਸ਼ੰਕਰ ਪਟਿਆਲਾ ਪਟਿਆਲਾ ਅਸੀਂ ਬਹੁਤ ਸਾਰੀਆਂ ਥਾਵਾਂ 'ਤੇ ਘੁੰਮਣ ਜਾਂਦੇ ਹਾਂ ਅਤੇ ਠੀਕ ਹੈ ਸਾਨੂੰ ਬਹੁਤ ਵਧੀਆ ਹੀ ਲੱਗਦੀਆਂ ਹਨ ਅਤੇ ਕੋਆਲਟੀ ਬਹੁਤ ਵਧੀਆ ਹੈ ਜਿਵੇਂ ਪਹਾੜੀਆਂ ਦੀ ਲੌਕੇਸ਼ਨ ਹਿਮਾਚਲ ਵਿੱਚ ਬਹੁਤ ਵਧੀਆ ਹੁੰਦੀ ਹੈ ਅਤੇ ਜਿਵੇਂ ਕਿ ਅਤੇ ਇਹ ਉਸ ਦੇ ਵਿੱਚ ਸ਼ਿਮਲੇ ਵਿੱਚ ਬਰਫ਼ ਪੈਂਦੀ ਹੈ ਬਹੁਤ ਸਾਰੀ ਬ ਬਹੁਤ ਵਧੀਆ ਬਰਫ਼ ਪੈਂਦੀ ਜਿਵੇਂ ਸ਼ਿਮਲੇ ਦੇ ਵਿੱਚ